ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੀ ਭਾਸ਼ਾ ਭੋਜਨ ਕੱਪੜੇ ਅਲੱਗ ਅਲੱਗ ਹਨ ਅਤੇ ਮੌਸਮ ਵੀ ਅਲੱਗ ਹੈ